ਮੇਰੇ ਖੇਤਰ ਵਿੱਚ ਜੋ ਕੁਦਰਤੀ ਸਰੋਤ ਹੈ ਅਤੇ ਜਿਸ ਨੂੰ ਵਪਾਰਕ ਗਤੀਵਿਧੀਆਂ ਲਈ ਵਰਤਿਆਂ ਜਾ ਸਕਦਾ ਹੈ ਉਹ ਅੰਨ ਜਾਂ ਅਨਾਜ ਹੈ ਕਿਉਂ ਕਰਕੇ ਮੈਂ ਜਿਸ ਸੂਬੇ ਵਿੱਚ ਰਹਿੰਦਾ ਹਾਂ ਉਹ ਮੁੱਖ ਤੌਰ ਉੱਤੇ ਖੇਤੀਬਾੜੀ ਸੂਬਾ ਹੈ ਅਤੇ ਇੱਥੇ ਵਧੇਰੇ ਤੌਰ ਉੱਤੇ ਕਣਕ ਅਤੇ ਝੋਨਾ ਫਸਲਾਂ ਉਗਾਈਆਂ ਜਾਂਦੀਆ ਨੇ ਇਸ ਤੋਂ ਇਲਾਵਾ ਮੱਕੀ ਕਪਾਹ ਗੰਨਾ ਵਰਗੀਆਂ ਫਸਲਾਂ ਵੀ ਇੱਥੇ ਉਗਾਈਆਂ ਜਾਂਦੀਆਂ ਹਨ ਇਹ ਫਸਲਾਂ ਵਪਾਰਕ ਤੌਰ ਉੱਤੇ ਦੂਸਰੇ ਦੇਸ਼ਾਂ ਨੂੰ ਸਪਲਾਈ ਵੀ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਵਪਾਰਕ ਗਤੀਆ ਵਿਧੀਆਂ ਲਈ ਇਹ ਸਾਡਾ ਮੁੱਖ ਕੁਦਰਤੀ ਸਰੋਤ ਹਨ ਦੂਸਰੇ ਮੁਲਕਾਂ ਤੱਕ ਵਪਾਰਕ ਚੀਜ਼ਾਂ ਪਹੁੰਚਾਉਣ ਦੇ ਵਿੱਚ ਅਸੀਂ ਇਹਨਾਂ ਕੁਦਰਤੀ ਸਰੋਤਾਂ ਨੂੰ ਵਰਤ ਵੀ ਸਕਦੇ ਹਾਂ ਜਿਸ ਨਾਲ ਇੱਥੋਂ ਦਾ ਕਿਸਾਨ ਖੁਸ਼ਹਾਲ ਵੀ ਹੋ ਸਕਦਾ ਹੈ ਜੇਕਰ ਪਾਕਿਸਤਾਨ ਵਾਹਗਾ ਬਾਡਰ ਖੋਲਿਆ ਜਾਵੇ ਤਾਂ ਯੋਰਪ ਨੂੰ ਇੱਥੋਂ ਦਾ ਇਹ ਸਾਰਾ ਕੁਦਰਤੀ ਸਰੋਤ ਜੋ ਇੱਥੇ ਅਨਾਜ ਅੰਨ ਪੈਦਾ ਕੀਤਾ ਜਾਂਦਾ ਹੈ ਉਹ ਵਪਾਰਕ ਤੌਰ ਉਤੇ ਵਰਤਿਆ ਵੀ ਜਾ ਸਕਦਾ ਹੈ